ਮੈਂ ਕੁੜਤੀ ਮੰਗਾਈ ਸੀ ਤੇ ਉਹ ਅਜੇ ਤੱਕ ਆਈ ਨਹੀਂ ਹੈ ਤੇ ਮੈਂ ਉਸ ਬਾਰੇ ਬਹੁਤ ਚਿੰਤਿਤ ਆਂ ਤੇ ਦੂਜੀ ਗੱਲ ਮੈਂ ਉਹਦੀ ਪੈਸੇ ਵੀ ਔ ਪਹਿਲਾਂ ਹੀ ਪੇ ਦੇ ਚੁੱਕੀ ਆ ਉਹਨਾਂ ਨੂੰ ਆਨਲਾਈਨ ਜੀਪੇ ਦੇ ਰਾਹੀਂ ਤੇ ਮੈਨੂੰ ਹੈਗਾ ਵੀ ਮਤਲਬ ਮੇਰਾ ਆਰਡਰ ਆ ਜਾਵੇ ਕਿਉਂਕਿ ਮੈਂ ਵੀਹ ਤਰੀਕ ਨੂੰ ਆਰਡਰ ਕੀਤਾ ਸੀ ਤੇ ਅੱਜ ਛੱਬੀ ਤਰੀਕ ਹੋ ਗਈ ਤੇ ਅਠਾਈ ਤਰੀਕ ਨੂੰ ਮੇਰਾ ਬਰਥਡੇ ਹੈ ਤੇ ਮੇਰਾ ਜਨਮ ਦਿਨ ਹੈ ਤੇ ਮੈਨੂੰ ਹੈਗਾ ਵੀ ਮੇਰਾ ਆਰਡਰ ਆ ਜਾਵੇ ਸੋ ਇਸ ਲਈ ਮੈਨੂੰ ਦੱਸਿਆ ਜਾਵੇ ਵੀ ਮੇਰਾ ਆਰਡਰ ਕਿੱਥੇ ਹੈ ਤੇ ਮੈਂ ਕਸਟਮਰ ਕੇਅਰ ਤੇ ਵੀ ਕਾਲ ਲਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਚੱਕ ਕੇ ਕੋਈ ਮੈਨੂੰ ਖਾਸ ਜਵਾਬ ਨਹੀਂ ਦਿੱਤਾ ਵੀ ਮੇਰਾ ਆਰਡਰ ਅਜੇ ਤੱਕ ਕਿੱਥੇ ਐ ਤੇ ਮੈਨੂੰ ਦੱਸਿਆ ਜਾਵੇ ਤੇ ਮੈਂ ਬਹੁਤ ਠੀਕ ਠੀਕ ਪਰਿਵਾਰ ਤੋਂ ਸੰਬੰਧ ਰੱਖਦੀ ਆ ਇਸ ਲਈ ਮੇਰੇ ਘਰ ਦੇ ਵੀ ਮੈਨੂੰ ਪੁੱਛ ਰਹੇ ਨੇ ਬਾਰ ਬਾਰ ਵੀ ਤੇਰਾ ਆਰਡਰ ਕਿੱਥੇ ਹੈ ਮੈਂ ਇਸ ਲਈ ਜਿਆਦਾ ਚਿੰਤਤ ਆ ਕਿਉਂਕਿ ਅੱਜ ਕੱਲ ਫਰਾਡ ਬੜੇ ਹੁੰਦੇ ਆ ਤੇ ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਜਾਂਦਾ ਤੇ ਇਸ ਲਈ ਪਲੀਜ਼ ਮੈਰੇ ਆਰਡਰ ਦੀ ਜਾਂਚ ਕੀਤੀ ਜਾਵੇ ਤੇ ਤੁਸੀਂ ਵੀ ਦੱਸੋ ਮੇਰਾ ਆਰਡਰ ਅਜੇ ਤੱਕ ਮੇਰੇ ਕੋਲ ਆਇਆ ਨਹੀਂ ਹੈ ਤੇ ਮੈਨੂੰ ਉਹਦਾ ਸਾਰਾ ਡਿਟੇਲ ਦੱਸੀ ਜਾਵੇ ਤੇ ਕਿਉਂਕਿ ਮੈਨੂੰ ਮੇਰੇ ਘਰਦਿਆਂ ਤੋਂ ਵੀ ਗਾਲਾ ਪੈਂਦੀਆਂ ਪਈਆਂ ਤੇ ਉਹ ਵੀ ਬਹੁਤ ਚਿੰਤਤ ਨੇ ਵੀ ਤੂੰ ਆਰਡਰ ਕਰਤਾ ਤੇ ਅਜੇ ਤੱਕ ਆਇਆ ਨਹੀਂ ਐ ਤੇ ਇਸ ਲਈ ਪਲੀਜ਼ ਕਿਰਪਾ ਕਰਕੇ ਮੇਰਾ ਆਰਡਰ ਮੈਨੂੰ ਦੱਸਿਆ ਜਾਵੇ ਕਿੱਥੇ ਹੈ ਕਿੱਥੇ ਨਹੀਂ